ਅਸੀਂ ਘਰ ਵਿੱਚ ਬਣਾਉਣ ਵਾਲੀਆਂ ਚੀਜ਼ਾਂ ਬਣਾਉਂਦੇ ਹਾਂ ਪੀਣ ਵਾਲੀਆਂ ਜਿਵੇਂ ਕਿ ਜਲ ਜੀਰਾ ਮੈਂਗੋ ਸ਼ੇਕ ਬਨਾਨਾ ਸ਼ੇਕ ਲੱਸੀ ਜਲ ਜੀਰਾ ਸ਼ਿਕੰਜਵੀ ਰੂਹਫ਼ਜਾ ਕੌਫੀ ਗਰੀਨ ਟੀ ਕੋਲਡ ਕੌਫੀ ਇੱਦਾਂ ਦੀਆਂ ਜਿਵੇਂ ਕੋਲਡਰਿੰਕਸ ਵਗੈਰਾ ਬਹੁਤ ਹੀ ਘਰ ਵਿੱਚ ਅਸੀਂ ਪੀਂ ਬਣਾਉਂਦੇ ਹਾਂ ਨਿੰਬੂ ਪਾਣੀ